ਸਾਡੇ ਖੇਤਰ ਵਿੱਚ ਮੀਂਹ ਕਣੀ ਨੂੰ ਆਪਾਂ ਬਹੁਤ ਚੰਗੇ ਤਰ੍ਹਾਂ ਯੂਜ਼ ਕਰ ਸਕਦੇ ਹਾਂ ਆਪਣੇ ਵਪਾਰਕ ਗਤੀਵਿਧੀਆਂ ਲਈ ਮੀਂਹ ਨੂੰ ਯਾਨੀ ਕਿ ਬਾਰਿਸ਼ ਦੇ ਪਾਣੀ ਨੂੰ ਆਪਾਂ ਹਰਵੈਸਟਿੰਗ ਲਈ ਯੂਜ਼ ਕਰ ਸਕਦੇ ਹਾਂ ਪੰਜਾਬ 'ਚ ਅਤੇ ਜੋ ਕਿ ਅਸੀਂ ਕਰਦੇ ਵੀ ਹਾਂ ਅਤੇ ਸਾਡੇ ਪੰਜਾਬ 'ਚ ਸੁੱਖ ਨਾਲ ਬਹੁਤ ਅੱਛੀ ਧੁੱਪ ਨਿਕਲਦੀ ਹੈ ਧੁੱਪ ਨਾਲ ਅਸੀਂ ਸੋਲਰ ਪੈਨਲ ਲਾਉਂਦੇ ਹਾਂ ਘਰਾਂ 'ਚ ਸੋਲਰ ਪੈਨਲ ਕੀ ਕਰਦਾ ਕਿ ਧੁੱਪ ਦੀ ਕਿਰਨਾਂ ਨਾਲ ਇਲੈਕਟ੍ਰੀਸਿਟੀ ਪੈਦਾ ਕਰਦੀ ਹੈ ਅਤੇ ਇਲੈਕਟ੍ਰੀਸਿਟੀ ਨਾਲ ਅਸੀਂ ਬਹੁਤ ਕੰਮ ਕਰ ਸਕਦੇ ਹਾਂ ਪੰਜਾਬ 'ਚ ਉਂਝ ਤਾਂ ਇਲੈਕਟ੍ਰੀਸਿਟੀ ਬਹੁਤ ਹੈ ਸਰਪਲਸ 'ਚ ਹੈ ਲੇਕਿਨ ਫਿਰ ਵੀ ਬਹੁਤ ਕੱਟ ਲੱਗਦੇ ਨੇ ਅਤੇ ਜਿਹਦੇ ਕਾਰਨ ਥੋੜ੍ਹਾ ਬਹੁਤ ਪ੍ਰਭਾਵ ਪੈਂਦਾ ਹੀ ਹੈ ਸਾਡੇ ਵਪਾਰਕ ਗਤੀਵਿਧੀ 'ਤੇ ਅਤੇ ਜੇਕਰ ਅਸੀਂ ਸੋਲਰ ਪੈਨਲ ਦੀ ਜਦੋਂ ਵਰਤੋਂ ਕਰੀ ਦੀ ਹੈ ਅਤੇ ਉਹੀ ਸਰਕਾਰ ਨੂੰ ਵੀ ਫਾਇਦਾ ਹੋ ਜਾਂਦਾ ਅਤੇ ਸਾਡੇ ਵਪਾਰਕ ਗਤੀਵਿਧੀਆਂ ਵਿੱਚ ਵੀ ਉਸ ਚੀਜ਼ ਦਾ ਬਹੁਤ ਫਾਇਦਾ ਅਸੀਂ ਲਾਭ ਉਠਾਉਂਦੇ ਹਾਂ ਉਸ ਚੀਜ਼ ਦਾ ਸੋਲਰ ਪੈਨਲ ਨਾਲ ਆਪਾਂ ਅੱਛੀ ਖਾਸੀ ਧੁੱਪ ਨਾਲ ਆਪਣਾ ਇਲੈਕਟ੍ਰੀਸਿਟੀ ਬਣਾਉਂਦੇ ਹਾਂ ਬਿਜਲੀ ਬਣਾਈ ਦੀ ਅਤੇ ਉਹ ਬਿਜਲੀ ਫਿਰ ਹੋਰ ਸਾਡੇ ਵਪਾਰਕ ਕੰਮ ਲਈ ਯੂਜ਼ ਹੁੰਦੀ ਹੈ ਹਰਵੈਸਟਿੰਗ ਵਾਸਤੇ ਅਤੇ ਉਸੀ ਨਾਲ ਸਾਡੀ ਵਪਾਰਕ ਗਤੀਵਿਧੀ ਵਧੀਆ ਹੋ ਜਾਂਦੀ ਹੈ ਚੰਗੀ ਹੋ ਜਾਂਦੀ ਹੈ ਅਤੇ ਜਿੱਦਾਂ ਕਿ ਮੀਂਹ ਕਣੀ ਨਾਲ ਆਪਾਂ ਰੇਨ ਹਰਵਾ ਹਰਵੈਸਟਿੰਗ ਅੱਛੀ ਕਰ ਲੈਂਦੇ ਹਾਂ ਅਤੇ ਹੋਰ ਖੇਤਰ ਵਿੱਚ ਓਵਰਔਲ ਸਾਡੀ ਵਪਾਰਕ ਗਤੀਵਿਧੀ ਵਧੀਆ ਹੋ ਜਾਂਦੀ ਹੈ